ਭੰਗੜਾ ਪੰਜਾਬੀਆਂ ਦਾ ਇੱਕ ਖ਼ਾਸ ਮਤਲਬ ਜੋ ਹੈ ਲੋਕ ਨ੍ਰਿਤ ਹੈਗਾ ਹੈ ਜਿਹਦੇ ਬਿਨਾਂ ਕੋਈ ਵੀ ਵਿਆਹ ਸ਼ਾਦੀ ਜਿਹੜਾ ਹੈਗਾ ਹੈ ਉਹ ਸੰਪੂਰਨ ਹੀ ਨਹੀਂ ਮੰਨਿਆ ਜਾਂਦਾ ਲੇਕਿਨ ਇਹ ਗੱਲ ਮੈਂ ਪਹਿਲੀ ਵਾਰੀ ਸੁਣੀ ਹੈ ਕਿ ਭੰਗੜੇ ਬਾਰੇ ਵੀ ਕੁਛ ਗਲਤ ਧਾਰਨਾਵਾਂ ਹਨ ਕਿਉਂਕਿ ਇਹਦੇ ਬਾਰੇ ਕੋਈ ਗਲਤ ਧਾਰਨਾਵਾਂ ਕਿਵੇਂ ਹੋ ਸਕਦੀਆਂ ਹਨ ਕਿਉਂਕਿ ਭੰਗੜਾ ਇੱਕ ਇਹੋ ਜਿਹਾ ਜਿਹੜਾ ਹਰ ਮੌਕੇ 'ਤੇ ਅਸੀਂ ਖੁਸ਼ੀ ਦੇ ਮੌਕੇ 'ਤੇ ਪਾਉਂਦੇ ਹਾਂ ਔਰ ਭੰਗੜਾ ਇੰਨਾ ਆਸਾਨ ਹੈ ਕਿ ਇਹਦੇ ਸਟੈਪ ਜੋ ਹ ਬੜੇ ਆਸਾਨੀ ਨਾਲ ਕੀਤੇ ਜਾ ਸਕਦੇ ਕੱਥਕ ਦੇ ਨਾਲ ਅਗਰ ਆਪਾਂ ਭੰਗੜੇ ਨੂੰ ਕੰਪੇਅਰ ਕਰੀਏ ਤਾਂ ਭੰਗੜਾ ਬਹੁਤ ਇਜੀ ਹੈ ਜਦੋਂ ਕਿ ਕੱਥਕ ਨੂੰ ਦੇ ਜੋ ਸਟੈਪ ਨੇ ਜਾਂ ਕੱਥਕ ਨੂੰ ਕਰਨਾ ਹਰ ਕਿਸੇ ਦੇ ਮਤਲਬ ਬਸ ਦੀ ਗੱਲ ਨਹੀਂ ਹੈ ਪਰ ਭੰਗੜਾ ਅਸੀਂ ਆਸਾਨੀ ਨਾਲ ਜੋ ਹੈ ਪਾ ਸਕਦੇ ਹਾਂ ਔਰ ਮੈਨੂੰ ਲੱਗਦਾ ਨਹੀਂ ਹੈ ਕਿ ਇਹਦੇ 'ਚ ਕੋਈ ਗਲਤ ਧਾਰਨਾਵਾਂ ਹੈ ਫਿਰ ਵੀ ਅਗਰ ਕੋਈ ਇਹ ਸਮਝਦਾ ਹੈ ਕਿ ਭੰਗੜੇ ਦੇ ਨਾਲ ਕੋਈ ਹੈਲਥ ਪ੍ਰੋਬਲਮ ਜਾਂ ਸਰੀਰ ਦੇ ਲਚਕ ਲੁਚਕ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਭੰਗੜੇ ਦੇ ਸਟੈਪ ਬਾਏ ਸਟੈਪ ਸਿੱਖ ਕੇ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਵੈਸੇ ਭੰਗੜੇ ਦੇ ਤੁਹਾਨੂੰ ਫਾਇਦੇ ਹੀ ਨੇ ਕਿਉਂਕਿ ਭੰਗੜਾ ਕਰਦੇ ਆ ਤਾ ਸਾਡਾ ਪੂਰਾ ਸਰੀਰ ਜੋ ਹੈ ਉਹ ਐਕਟਿਵ ਹੁੰਦਾ ਖ਼ਾਸ ਕਰਕੇ ਲੱਤਾਂ ਦੇ ਐਕਸਰਸਾਈਜ਼ ਹੁੰਦੀ ਹੈ ਜਿਹੜੇ ਲੋਕਾਂ ਨੂੰ ਲੈਗਸ ਦੀ ਪ੍ਰੋਬਲਮ ਰਹਿੰਦੀ ਆ ਉਹਨਾਂ ਨੂੰ ਹਲਕਾ ਫੁਲਕਾ ਜੋ ਲੱਤਾਂ ਦੀ ਐਕਸਰਸਾਈਜ਼ ਦੇ ਲਈ ਭੰਗੜਾ ਪਾਉਣਾ ਚਾਹੀਦਾ ਹੈ ਜੇ ਉਹ ਜਿਮ ਦੇ ਵਿੱਚ ਟਾਈਮ ਨਹੀਂ ਕੱਢ ਸਕਦੇ ਅਤੇ ਜਿਹੜੀਆਂ ਮਹਿਲਾਵਾਂ ਨੱਚਣ ਗਾਉਣ ਦੀਆਂ ਸ਼ੌਕੀਨ ਨੇ ਉਹਨਾਂ ਨੂੰ ਵੀ ਭੰਗੜਾ ਜ਼ਰੂਰ ਸਿੱਖਣਾ ਚਾਹੀਦਾ ਢੋਲ ਦੀ ਬੀਟ ਉੱਤੇ ਪਾਇਆ ਭੰਗੜਾ ਓਦਾਂ ਹੀ ਕਹਿੰਦੇ ਆ ਤੁਹਾਡੇ ਰੂਹ ਰੂਹ ਨੂੰ ਜੋ ਹੈ ਐਕਟਿਵ ਕਰ ਦਿੰਦਾ ਇਹਦੇ ਨਾਲ ਤੁਹਾਡੀ ਸਿਰਫ ਲੱਤਾਂ ਹੀ ਨਹੀਂ ਬਾਕੀ ਬਾਕੀ ਸਰੀਰ ਦੀ ਦਿਮਾਗ ਦੀ ਵੀ ਇੱਕ ਅੱਛੀ ਐਕਸਰਸਾਈਜ਼ ਹੁੰਦੀ ਹੈ